ਦੇਖੋ ਜੀ ਸਾਡੇ ਭਾਰਤ ਵਿੱਚ ਲੋਕ ਖਾਣ ਪੀਣ ਦੇ ਬਹੁਤ ਸ਼ੋਕੀਨ ਹਨ ਅਤੇ ਉਹਦੇ 'ਤੇ ਲੋਕ ਜ਼ਿਆਦਾਤਰ ਮਸਾਲੇਦਾਰ ਚੀਜ਼ਾਂ ਖਾਣੀਆਂ ਪਸੰਦ ਕਰਦੇ ਹਨ ਅਤੇ ਜੇਕਰ ਮੈਂ ਗੱਲ ਕਰਾਂ ਆਪਣੀ ਤਾਂ ਮੈਂ ਰੋਜ਼ ਸਵੇਰੇ ਸਵੇਰੇ ਪਰੌਂਠੇ ਖਾਂਦਾ ਹਨ ਵੈਸੇ ਪਰ ਮੇਰੇ ਘਰ ਹਰ ਐਤਵਾਰ ਆਲੂ ਦੇ ਪਰੌਂਠੇ ਮੂਲੀ ਦੇ ਪਿਆਜ਼ ਦੇ ਬਣਦੇ ਹਨ ਤੇ ਪਰ ਮੈਨੂੰ ਜ਼ਿਆਦਾਤਰ ਪਸੰਦ ਹੈਗੇ ਆਲੂ ਦੇ ਪਰੌਂਠੇ ਅਤੇ ਦਾ ਸਾਡੇ ਉਰੇ ਦਾਲਾ ਸਬਜ਼ੀਆਂ ਵੀ ਬਣਦੀਆਂ ਹਨ ਹਰੇਕ ਚੀਜ਼ਾਂ ਦੀਆਂ ਅਤੇ ਜੇਕਰ ਮੈਂ ਗੱਲ ਕਰਾਂ ਮਸਾਲੇ ਦੀ ਤਾਂ ਸਾਡੇ ਦੇਸ਼ ਦੇ ਮਸਾਲੇ ਹਰੇਕ ਤਰ੍ਹਾਂ ਹਰੇਕ ਤਰ੍ਹਾਂ ਦੇ ਵਧੀਆ ਹਨ ਅਤੇ ਹਰੇਕ ਦੇਸ਼ ਜਾਂਦੇ ਹਨ ਅਤੇ ਇਹ ਮੈਨੂੰ ਬੜੀ ਮਾਣ ਵਾਲੀ ਗੱਲ ਲੱਗਦੀ ਹੈ